ਸਤਿ ਸ਼੍ਰੀ ਅਕਾਲ ਜੀ ਤੁਸੀ ਡੋਕਟਰ ਜੈਸਮੀਨ ਬੋਲਦੇ ਹੋ ਫਿਜ਼ੀਓਥਰੈਪੀਸਟ ਦੇ ਡੋਕਟਰ ਉਹ ਮੈਨੂੰ ਨਾ ਤੁਹਾਡਾ ਨੰਬਰ ਆਪਣੇ ਨਾਲ਼ ਇੱਕ ਆਂਟੀ ਸੀ ਰਹਿੰਦੇ ਆ ਉਹਨਾਂ ਤੋਂ ਲੀਤਾ ਸੀਗਾ ਅਸਲ 'ਚ ਤਾਂ ਮੇਰੇ ਨਾ ਗਰਦਨ ਦੇ ਵਿੱਚ ਬਹੁਤ ਜ਼ਿਆਦਾ ਪੇਨ ਰਹਿ ਰਿਹਾ ਕਾਫੀ ਦਿਨ ਤੋਂ ਤਾਂ ਮੈਂ ਉਹਦੇ ਬਾਰੇ ਥੋਤੋਂ ਸਲਾਹ ਲੈਣੀ ਸੀ ਜਿੱਦਾਂ ਨਾ ਮੇਰੇ ਥੋੜ੍ਹੇ ਪੇਪਰ ਚੱਲ ਰਹੇ ਸੀਗੇ ਤਾਂ ਕਰਕੇ ਮੈਂ ਦੇਖਦੀ ਜਦੋਂ ਐਦਾਂ ਹੁੰਦਾ ਆ ਮੇਰੇ ਪੇਪਰ ਨੇੜੇ ਆਉਂਦੇ ਆ ਮੇਰੀ ਗਰਦਨ ਦੇ ਵਿੱਚ ਕਾਫੀ ਦਰਦ ਰਹਿਣ ਲੱਗ ਜਾਂਦਾ ਉਂਝ ਵੀ ਵੇ ਜਿਵੇਂ ਮੈਂ ਨੀਵੇਂ ਝੁਕ ਕੇ ਕੋਈ ਵੀ ਕੰਮ ਕਰਨ ਲੱਗਦੀ ਹਾਂ ਰਸੋਈ ਦੇ ਵਿੱਚ ਜਾਂ ਕੁਝ ਵੀ ਕਿੱਦਾਂ ਮਰਜ਼ੀ ਦਾ ਨੀਚੇ ਝੁਕ ਕੇ ਕੰਮ ਕਰਨਾ ਹੋਵੇ ਤਾਂ ਬਹੁਤ ਜ਼ਿਆਦਾ ਦਰਦ ਗਰਦਨ ਦੇ ਵਿੱਚ ਦਰਦ ਹੋਣ ਲੱਗ ਪੈਂਦਾ ਪਤਾ ਨਹੀਂ ਕਿਉਂ ਨਹੀਂ ਨਹੀਂ ਸਿਰ ਤੱਕ ਚਲ ਜਾਂਦਾ ਕਦੇ ਕਦੇ ਬਾਹਾਂ ਤਾਂ ਬਹੁਤ ਘੱਟ ਹੀ ਦਰਦ ਹੁੰਦੀਆਂ ਨਹੀਂ ਮੈਂ ਵੈਸੇ ਟਰਾਈ ਤਾਂ ਕਰਦੀ ਹੁੰਦੀ ਹਾਂ ਕਿ ਵੀ ਨਾ ਕਰਾਂ ਵੀ ਸਹੀ ਪੋਸਚਰ ਦੇ ਵਿੱਚੋਂ ਬਟ ਕਈ ਵਾਰ ਹੋ ਜਾਂਦਾ ਵੀ ਹੈ ਨਾ ਨੀਚੇ ਝੁਕ ਕੇ ਕੰਮ ਹੋ ਜਾਂਦਾ ਹਾਂਜੀ ਉਹ ਤਾਂ ਹੁਣ ਜਿੱਦਾਂ ਅੱਜ ਕੱਲ੍ਹ ਸਾਰਾ ਕੁਝ ਔਨਲਾਈਨ ਹੈ ਤਾਂ ਫਿਰ ਕਰਨਾ ਹੀ ਪੈਂਦਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਫੇਰ ਮੈਂ ਤੁਹਾਨੂੰ ਮਿਲ ਲਵਾਂਗੀ ਕੱਲ੍ਹ ਨੂੰ ਆ ਕੇ ਤੁਹਾਡੇ ਕਲੀਨਿਕ ਦੇ ਵਿੱਚ ਓਕੇ ਸਤਿ ਸ਼੍ਰੀ ਅਕਾਲ ਜੀ